ਮੈਂ ਦੇਖਿਆ ਕਿ ਮੇਰੇ ਪਿੰਡ ਵਿੱਚ ਅਜੇ ਪਿਛਲੇ ਹੀ ਹਫ਼ਤੇ ਇੱਕ ਘਟਨਾ ਘਟੀ ਸੀ ਇੱਕ ਮੁੰਡਿਆ ਜਿਹੜਾ ਕਿ ਉਹ ਆਪਣੇ ਪਾਪਾ ਦਾ ਕੰਮ ਕਰਨ ਵਿੱਚ ਸਹਾਇਤਾ ਕਰਾ ਰਿਹਾ ਸੀ ਉਹ ਪੱਠੇ ਵੱਢਣ ਵਾਲੀ ਮਸ਼ੀਨ ਦੇ ਵਿੱਚ ਪੱਠੇ ਵੱਢ ਕੇ ਜਾਨਵਰਾਂ ਨੂੰ ਪਾ ਰਿਹਾ ਸੀ ਕਿ ਅਚਾਨਕ ਹੀ ਪੱਠੇ ਵੱਢਦੇ ਵੱਢਦੇ ਉਸ ਦੀ ਸੱਜੀ ਉਂਗਲ ਜਿਹੜੀ ਹੈ ਉਹ ਮਸ਼ੀਨ ਦੇ ਵਿੱਚ ਨਾਲ ਹੀ ਵੱਢੀ ਗਈ ਅਤੇ ਉਸ ਤੋਂ ਬਾਅਦ ਉਸ ਨੂੰ ਬਹੁਤ ਹੀ ਜ਼ਿਆਦਾ ਤਕਲੀਫ ਹੋਈ ਅਤੇ ਬੱਚਾ ਜਿਹੜਾ ਸੀ ਉਹ ਘਬਰਾ ਗਿਆ ਬਹੁਤ ਜ਼ਿਆਦਾ ਅਤੇ ਉਸ ਦੇ ਉਸ ਸੱਜੀ ਉਂਗਲੀ ਦੇ ਵਿੱਚੋਂ ਬਹੁਤ ਜ਼ਿਆਦਾ ਹੀ ਖੂਨ ਵਗਣ ਲੱਗ ਪਿਆ ਤਾਂ ਪਹਿਲਾਂ ਤਾਂ ਫਟਾਫਟ ਇੱਕ ਕੱਪੜਾ ਫਾੜ ਕੇ ਉਸ ਦੀ ਉਸ ਉਂਗਲ ਤੋਂ ਲਪੇਟ ਦਿੱਤਾ ਚੰਗੀ ਤਰ੍ਹਾਂ ਉਸਨੂੰ ਬੰਨ ਦਿੱਤਾ ਤਾਂ ਜੋ ਉਸ ਦੇ ਉਸ ਦੇ ਸਰੀਰ ਚੋਂ ਹੋਰ ਖੂਨ ਜਿਹੜਾ ਹੈ ਉਹ ਨਾ ਨਿਕਲੇ ਫਿਰ ਅਸੀਂ ਉਸਨੂੰ ਫਟਾਫਟ ਐਂਬੂਲੈਂਸ ਗੱਡੀ ਵਿੱਚ ਪਾ ਕੇ ਉਸਨੂੰ ਤੁਰੰਤ ਹੋਸਪੀਟਲ ਲੈ ਕੇ ਗਏ ਤਾਂ ਡੋਕਟਰ ਨੇ ਉਸ ਦਾ ਇਲਾਜ ਕੀਤਾ ਅਤੇ ਉਸਦੀ ਇੱਕ ਪੁਰਾਣੀ ਉਂਗਲੀ ਜਿਹੜੀ ਹੈ ਉਹ ਲਗਾ ਦਿੱਤੀ